ਮੈਂ ਮਹੱਤਵਪੂਰਨ ਫੈਸਲਾ ਉਦੋਂ ਲਿਆ ਜਦੋਂ ਮੈਂ ਲੈਪਟੋਪ ਖਰੀਦਣਾ ਸੀ ਤਦੋਂ ਮੈਂ ਲੈਪਟੋਪ ਲੈਣ ਲਈ ਦੋ ਤਿੰਨ ਮਹੀਨਿਆਂ ਤੋਂ ਤਿਆਰੀ ਕਰ ਰਿਹਾ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸ ਤਰ੍ਹਾਂ ਦਾ ਅਤੇ ਕਿਹੜੀ ਕੰਪਨੀ ਦਾ ਲੈਪਟੋਪ ਖਰੀਦਾਂ ਫਿਰ ਮੇਰੇ ਦੋਸਤ ਅੰਸ਼ ਨੇ ਮੈਨੂੰ ਵਧੀਆ ਸਲਾਹ ਦਿੱਤੀ ਉਸ ਨੇ ਇੱਕ ਵਧੀਆ ਕੰਪਨੀ ਦਾ ਲੈਪਟੋਪ ਮੈਨੂੰ ਦੱਸਿਆ ਅਤੇ ਇੱਕ ਵਧੀਆ ਦਾਮ ਵਿੱਚ ਮੈਨੂੰ ਲੈ ਕੇ ਦਿੱਤਾ ਅਤੇ ਉਸ ਦੀ ਸਪੈਸੀਫਿਕੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਸੀਗੀ ਅਤੇ ਉਹ ਹੁਣ ਮੈਨੂੰ ਇੱਕ ਸਾਲ ਹੋ ਚੁੱਕਿਆ ਹੈ ਉਸ ਲੈਪਟੋਪ ਨੂੰ ਲਏ ਹੋਏ ਅੱਜ ਤੱਕ ਉਹ ਲੈਪਟੋਪ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਅਤੇ ਉਸ ਮੇਰੇ ਦੋਸਤ ਨੇ ਮੈਨੂੰ ਚੰਗੀ ਸਲਾਹ ਦਿੱਤੀ ਅਤੇ ਲੈਪਟੋਪਸ ਹਜ੍ਹੇ ਤੱਕ